ਸਤਿ ਸ੍ਰੀ ਅਕਾਲ ਸਰ ਮੇਰਾ ਨਾਮ ਆਰਤੀ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿੱਥੇ ਸਥਾਨ ਬਾਰੇ ਕਾਰੋਬਾਰਾਂ ਦੇ ਵੱਧਦੇ ਕਿਵੇਂ ਚਲਦੇ ਨੇ ਜਿਸ ਤਰ੍ਹਾਂ ਕਿ ਤੁਹਾਨੂੰ ਦੱਸਿਆ ਜਾਏ ਕਿ ਸਾਡੇ ਇੱਥੇ ਸੁਜਾਨਪੁਰ ਦੇ ਵਿੱਚ ਘੁੰਮਣ ਵਾਸਤੇ ਪਾਰਕਿੰਗ ਬਣੀ ਹੋਈ ਹੈ ਬਹੁਤ ਵਧੀਆ ਸਿਸਟਮ ਇੱਥੇ ਸੁਜਾਨਪੁਰ ਵਿੱਚ ਜਿਸ ਤਰ੍ਹਾਂ ਕਿ ਕੱਪੜਿਆਂ ਦਾ ਸ਼ੋਪਿੰਗ ਦੀ ਦੁਕਾਨਾਂ ਵੀ ਬਹੁਤ ਨੇ ਜੇ ਦੱਸਿਆ ਜਾਏ ਕਿ ਮਾਤਾ ਬਾਗ ਬਹੁਤ ਅੱਛਾ ਮੰਦਰ ਆ ਇੱਥੇ ਵੀ ਲੋਕ ਘੁੰਮਣ ਵਾਸਤੇ ਆਉਂਦੇ ਨੇ ਜਿਸ ਤਰ੍ਹਾਂ ਮਿੰਨੀ ਗੋਆ ਜੁਗੇਆਲ ਵਿੱਚ ਪੈਂਦਾ ਮੁਕੇਸਰਾਂ ਉੱਥੇ ਵੀ ਤਾਂ ਲੋਕ ਅੱਛੇ ਸਥਾਨ ਵਿੱਚ ਘੁੰਮਣ ਫਿਰਨ ਲਈ ਆਉਂਦੇ ਨੇ ਸੈਰ ਸਪਾਟੇ ਲਈ ਪਰੀਆਂ ਵਾਲਾ ਬਾਗ ਹੋਰ ਵੀ ਬਥੇਰੇ ਜਗ੍ਹਾ ਇੱਧਰ ਘੁੰਮਣ ਲਈ ਸਾਡੇ ਪੰਜਾਬ ਵਿੱਚ ਅੱਛੇ ਅੱਛੇ ਸਥਾਨ ਨੇ ਉੱਥੇ ਲੋਕ ਫੁੱਲੀਆਂ ਪ੍ਰਸ਼ਾਦ ਫੁੱਲਾਂ ਦੇ ਹਾਰ ਇਸ ਤਰ੍ਹਾਂ ਵੀ ਦੇਖ ਕੇ ਆਪਣੇ ਕਾਰੋਬਾਰ ਚਲਾਉਂਦੇ ਨੇ ਇਸ ਤਰ੍ਹਾਂ ਕਿ ਵੱਧ ਤੋਂ ਵੱਧ ਹੋਰ ਵੀ ਮੇਲੇ ਲਗਾਉਂਦੇ ਜਿਸ ਤਰ੍ਹਾਂ ਭਗਵਾਨ ਦੇ ਮੰਦਰ ਵਿੱਚ ਜਾ ਕੇ ਫੋਟੋ ਪ੍ਰਸ਼ਾਦ ਇਸ ਤਰ੍ਹਾਂ ਸਭ ਕੁਛ ਮੇਲੇ ਵੀ ਲੱਗਦੇ ਹਨ ਬਹੁਤ ਜ਼ਿਆਦਾ ਘੁੰਮਣ ਵਾਲੀ ਜਗ੍ਹਾ ਇੱਥੇ ਸਾਡੇ ਸਥਾਨ ਵਿੱਚ ਜਿਸ ਤਰ੍ਹਾਂ ਕਿ ਮੰਦਰ ਵੀ ਬਹੁਤ ਜ਼ਿਆਦਾ ਨੇ ਇੱਥੇ